ਅ ਅੱਜ ਕੱਲ੍ਹ ਪੰਜਾਬ ਵਿੱਚ ਕਲਾ ਅਤੇ ਸ਼ਿਲਕ ਸ਼ਿਲਪ ਖੇਤਰ ਨੂੰ ਸਮਾਜਿਕ ਅਤੇ ਸੱਭਿਆਚਾਰਕ ਸ਼ਮੂਲੀਅਤ ਮਿਲ ਰਹੀ ਹੈ ਲੇਕਿਨ ਅਗਰ ਅਸੀਂ ਗੱਲ ਕਰਦੇ ਹਾਂ ਪਿਛਲੇ ਕੁਛ ਸਮੇਂ ਦੀ ਜਦ ਇਹਨਾਂ ਨੂੰ ਇੰਨੀ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ ਕਈ ਆਹ ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਹਨਾਂ ਵਿੱਚ ਜਿਹੜੀ ਕਲਾ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਲੇਕਿਨ ਉਹ ਆਪਣੇ ਇਸ ਕਲਾ ਨੂੰ ਅੱਗੇ ਅੱਗੇ ਪਰਸਿਓ ਅੱਗੇ ਆਹਾ ਵਧਾਉਣਾ ਅਤੇ ਇਸਦੇ ਵਿੱਚ ਅੱਗੇ ਕੰਮ ਕਰਨਾ ਚਾਹੁੰਦੇ ਹਨ ਲੇਕਿਨ ਜਿਹੜਾ ਸਮਾਜ ਹੈ ਉਹ ਕਲਾ ਨੂੰ ਐ ਐਸਾ ਇੱਕ ਕਿੱਤਾ ਕੰਮ ਕਿੱਤਾ ਜਾਂ ਕੰਮ ਦੇ ਤੌਰ 'ਤੇ ਨਹੀਂ ਦੇਖਦਾ ਜੇਕਰ ਕੋਈ ਜ ਕਲਾਕਾਰ ਹੈ ਉਹ ਆਪਣਾ ਕ ਆਪਣੀ ਕਲਾ ਦਿਖਾਉਂਦਾ ਹੈ ਉਹ ਲੋਕ ਉਹ ਉਹਦੀ ਵਡਿਆਈ ਤਾਂ ਜ਼ਰੂਰ ਕਰਦੇ ਹਨ ਲੇਕਿਨ ਉਹਨੂੰ ਇੰਨੀ ਮਹੱਤਤਾ ਨਹੀਂ ਦਿੱਤੀ ਜਾਂਦੀ ਉਹ ਫਿਰ ਵੀ ਉਹਨੂੰ ਪੁੱਛਦੇ ਹਨ ਤੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਿਆ ਆਹ ਕੀ ਕਰਦਾ ਹੈ ਲੇਕਿਨ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਜਿਹੜੇ ਹੈ ਆਪਣੀ ਕਲਾ ਨੂੰ ਇੰਟਰਨੈਟ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੂਸਰੇ ਲੋਕਾਂ ਨੂੰ ਦਿਖਾ ਰਹੇ ਨੇ ਅਤੇ ਲੋਕ ਉਸ ਨੂੰ ਪਸੰਦ ਵੀ ਕਰ ਰਹੇ ਨੇ ਇਸੇ ਸੋਸ਼ਲ ਮੀਡੀਆ ਕਾਰਨ ਉਹ ਕੁਛ ਆਪਣਾ ਜਿਹੜੀ ਆਪਣੀ ਕਲਾ ਦੇ ਦੁਆਰਾ ਕੁਛ ਆਪਣੀ ਕਮਾਈ ਕਰ ਪਾ ਰਹੇ ਨੇ ਲੇਕਿਨ ਅਗਰ ਅਗਰ ਆਪਾਂ ਬਿਲਕੁਲ ਆਹ ਗਰਾਊਂਡ ਰਿਐਲਿਟੀ ਦੇਖੀਏ ਅਤੇ ਜਿਹੜੇ ਲੋਕ ਹੈ ਹਜੇ ਵੀ ਕਲਾ ਨੂੰ ਇੰਨਾਂ ਹੀ ਇਮਪੋਰਟੈਂਸ ਨਹੀਂ ਦਿੰਦੇ ਆ ਉਹਨਾਂ ਉਹਨਾਂ ਨੂੰ ਹਜੇ ਵੀ ਉਹਨਾਂ ਦੀ ਸੋਚ ਇਹੀ ਹੈ ਕਿ ਜਿਹੜਾ ਇੱਕ ਬੱਚਾ ਹੈ ਉਹ ਇੰਜੀਨੀਅਰ ਡੋਕਟਰ ਜਾਂ ਕੋਈ ਪੜ੍ਹਾਈ ਦੇ ਖੇਤਰ ਵਿੱਚ ਅੱਗੇ ਵਧੇ ਲੇਕਿਨ ਕਈ ਬੱਚੇ ਜਿਹੜੇ ਹੁੰਦੇ ਆ ਉਹ ਪੜ੍ਹਾਈ ਦੇ ਖੇਤਰ ਵਿੱਚ ਨਹੀਂ ਜਿਹੜੇ ਕਲਾ ਦੇ ਖੇਤਰ ਵਿੱਚ ਵਧੀਆ ਹੁੰਦੇ ਨੇ ਅਤੇ ਉਸ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਇਸ ਕਰਕੇ ਆਹਾ ਉਹ ਇਸੇ ਵੱਲ ਜਾਣਾ ਚਾਹੁੰਦੇ ਨੇ ਲੇਕਿਨ ਜਿਹੜੇ ਆਹਾ ਅੱਜ ਕੱਲ੍ਹ ਆਪਣੇ ਲੋਕਾਂ ਦੇ ਵਿੱਚ ਆਹਾ ਸੋਚ ਵਿਚਾਰ ਹੈ ਉਸ ਕਾਰਨ ਉਹ ਇੰਨੀ ਮਹੱਤਤਾ ਨਹੀਂ ਦਿੰਦੇ ਆ ਕਲਾ ਅਤੇ ਕਲਾਕਾਰ ਨੂੰ ਇੰਨੀ ਮਹੱਤਤਾ ਨਹੀਂ ਦਿੰਦੇ ਜਿੰਨੀ ਉਹਨਾਂ ਨੂੰ ਮਹੱਤਤਾ ਮਿਲਣੀ ਚਾਹੀਦੀ ਹੈ ਲੇਕਿਨ ਅੱਜ ਕੱਲ੍ਹ ਦੀ ਮਾਸ ਮੀਡੀਆ ਦੇ ਸੋਸ਼ਲ ਮੀਡੀਆ ਦੇ ਦੁਨੀਆਂ ਵਿੱਚ ਜਿਹੜੀ ਉਹਨਾਂ ਨੂੰ ਥੋੜੀ ਬਹੁਤ ਇੰਪੋਰਟੈਂਸ ਮਿਲਣੀ ਸ਼ੁਰੂ ਹੋ ਰਹੀ ਹੈ ਅਤੇ ਮ ਮੇਰੀ ਇਹੀ ਇੱਛਾ ਹੈ ਕਿ ਹਰ ਕਲਾਕਾਰ ਨੂੰ ਉਸਦੀ ਜਿਹੜੀ ਮਹੱਤਤਾ ਹੈ ਉਹ ਸਮਾਜ ਵੱਲੋਂ ਮਿਲੇ ਧੰਨਵਾਦ